ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਹਾਂਜੀ ਵਧੀਆ ਜੀ ਥੋੜੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਬਣ ਰਿਹਾ ਜੀ ਇੱਥੇ ਪੰਜਾਬ ਮੋਹਾਲੀ ਆਉਣ ਦਾ ਅਤੇ ਏਅਰਪੋਰਟ ਆਉਣ ਤੋਂ ਬਾਅਦ ਇੱਥੋਂ ਗੁਰੂ ਘਰਾਂ ਦੇ ਇੱਥੇ ਦਰਸ਼ਨ ਕਰਨੇ ਜੀ ਕਿੱਥੇ ਕਿੱਥੇ ਆਪਾਂ ਕਦੋਂ ਕਦੋਂ ਜਾ ਸਕਦੇ ਹਾਂ ਕਿਹੜਾ ਸਮਾਂ ਤੁਹਾਡੇ ਕੋਲ ਅਵੇਲੇਵਲ ਹੈ ਹਫ਼ਤਾ ਦਸ ਦਿਨ ਲੱਗ ਸਕਦੇ ਹੈ ਜੀ ਹਾਂਜੀ

ਕਿਮ ਕਿਵੇਂ ਜਾਣਾ ਜੀ ਇੱਥੇ ਜੀ ਠੀਕ ਹੈ ਜੀ ਅਤੇ ਚਲ ਚਲੋ ਠੀਕ ਹੈ ਜੀ ਇਹਦੇ ਬਾਅਦ 'ਚ ਆਪਾਂ ਫਿਰ ਜਲਦੀ ਹੀ ਪ੍ਰੋਗਰਾਮ ਬਣਾਉਦੇ ਹਾਂ ਅਤੇ ਤੁਸੀਂ ਆਪਣਾ ਜਿਹੜਾ ਵਿਹਲ਼ ਹੈ ਇਹਦੇ ਬਾਰੇ ਕੱਢ ਕੇ ਰੱਖਣਾ ਜੀ ਛੇਤੀ ਆਪਾਂ ਰੱਖਦੇ ਹਾਂ ਜੀ ਠੀਕ ਹੈ ਜੀ ਠੀਕ ਓਕੇ ਜੀ ਓਕੇ ਜੀ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ